ਹੈਲੋ ਹਾਂਜੀ ਅਮਨ ਕੈਸੇ ਹੋ ਬਸ ਠੀਕ ਠਾਕ ਹਾਂਜੀ ਸਭ ਵਧੀਆ ਤੁਸੀਂ ਸਣਾਓ ਕੀ ਹਾਲ ਚਾਲ ਘਰੇ ਸਾਰੇ ਅਮਨ ਮੈਂ ਤੁਹਾਨੂੰ ਕਾਲ ਕਾਲ ਕੀਤੀ ਸੀਗੀ ਐਕਚੁਅਲ ਤੁਹਾਡੇ ਨਾਲ ਨਾ ਗੱਲ ਕਰਨੀ ਸੀਗੀ ਆਪਣੇ ਤੁਹਾਨੂੰ ਪਤਾ ਹੀ ਹੈ ਬੱਚੇ ਆਪਣੇ ਹੁਣ ਸਕੂਲ ਜਾਣ ਦੇ ਲਾਈਕ ਹੋ ਗਏ ਆ ਅਤੇ ਮੈਂ ਸੋਚ ਰਹੀ ਸੀ ਚਲੋ ਮੈਂ ਅਮਨ ਨਾਲ ਡਿਸਕਸ ਕਰਾਂ ਵੀ ਆਪਾਂ ਕਿਹੜਾ ਜਲੰਧਰ ਦੇ ਵਿੱਚ ਵਧੀਆ ਸਕੂਲ ਰਹੇਗਾ ਬੱਚਿਆਂ ਨੂੰ ਐਡਮਿਸ਼ਨ ਲਗਾਉਣ ਲਈ ਸਟਾਰਟਿੰਗ ਤੱਕ ਉਹਨਾਂ ਦਾ ਜਿਹੜਾ ਬੇਸ ਆ ਪ੍ਰੋਪਰ ਬਣ ਜਾਣਾ ਦੀ ਸ਼ੁਰੂਆਤ ਵਧੀਆ ਹੋ ਜਾਏ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਹਾਂਜੀ ਤਾਂ ਹੀ ਮੈਂ ਚਾਹੁੰਦੀ ਸੀ ਕਿ ਤੁਸੀਂ ਮੈਨੂੰ ਦੋ ਤਿੰਨ ਸਕੂਲਾਂ ਦੇ ਨਾਮ ਜਿਹੜੇ ਆ ਰਿਕਮੈਂਡ ਕਰੋ ਤਾਂ ਕਿ ਮੈਂ ਨਾ ਉਸ ਬਾਰੇ ਸੋਚਾਂ ਅਤੇ ਮੈਂ ਆਪਣੇ ਹਸਬੈਂਡ ਨੂੰ ਲੈ ਕੇ ਉੱਥੇ ਵਿਜ਼ਿਟ ਕਰਾਂ ਜਾ ਕੇ ਆਵਾਂ ਇੱਕ ਵਾਰੀ ਉਹਨਾਂ ਨੂੰ ਮਿਲ ਕੇ ਆਵਾਂ ਕਿਉਂਕਿ ਜਦੋਂ ਅਸੀਂ ਦੇਖ ਕੇ ਖੁਦ ਆਉਂਦੇ ਹਾਂ ਉਹ ਚੀਜ਼ ਅਲੱਗ ਸੁਣਨ ਅਤੇ ਦੇਖਣ ਦੇ ਵਿੱਚ ਬੜਾ ਫਰਕ ਹੋ ਜਾਂਦਾ ਨਾ ਸਮਝ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਜੀ ਅੱਛਾ ਹਾਂਜੀ ਹਾਂਜੀ ਕਰੋਲ ਬਾਗ

ਅਮਨ ਡਿਸਕ ਦੇ ਵਿੱਚ ਹਾਂਜੀ ਮੇਰੇ ਵੀ ਕੁਝ ਰਿਸ਼ਤੇਦਾਰ ਦੇ ਬੱ ਚੇ ਸੀਗੇ ਉੱਥੋਂ ਪਾਸ ਆਊਟ ਹੋਏ ਆ ਅਤੇ ਉਹ ਬੱਚੇ ਦੀ ਕਾਫੀ ਜ਼ਿਆਦਾ ਵੈਲ ਡਿਸਿਪਲਨ ਅਤੇ ਕਹਿ ਲਓ ਕਿ ਇੱਕ ਮੈਨਰਜ਼ ਵਾਲੇ ਬੱਚੇ ਨਿਕਲੇ ਆ ਮੈਨੂੰ ਵੀ ਉਹਦਾ ਬੜੀ ਚੀਜ਼ ਨੇ ਪ੍ਰਭਾਵਿਤ ਕੀਤਾ ਉਹਨਾਂ ਦੀ ਚੀਜ਼ ਨੇ ਕਿ ਇੱਕ ਸਕੂਲ ਦਾ ਜਦੋਂ ਇੱਕ ਇਮਪਰੈਸ਼ਨ ਪੈਂਦਾ ਉਹ ਬੱਚਿਆਂ ਦੇ ਥਰੂ ਹੀ ਹੁੰਦਾ ਬੱਚਾ ਕਿਸ ਤਰੀਕੇ ਦਾ ਨਿਕਲ ਕੇ ਆਇਆ ਹਾਂਜੀ ਨਹੀਂ ਸਕੂਲ ਦਾ ਹਾਂ ਕਰੀਕੁਲਮ ਕਿਸ ਤਰੀਕੇ ਦਾ ਆ ਬੱਚਿਆਂ ਨੂੰ ਜਿਹੜੀਆਂ ਆ ਖੇਡਾਂ ਵੱਲ ਕਿੰਨਾ ਕੁ ਰੱਖਿਆ ਜਾ ਰਿਹਾ ਕਿ ਬੱਚਿਆਂ ਨੂੰ ਸਿਰਫ ਇੱਕ ਤਾਂ ਹੁੰਦਾ ਨਾ ਦੇਖੋ ਸਕੂਲ ਹੈ ਕਿ ਸਿਰਫ ਪੜ੍ਹਾਈ ਦੇ ਉੱਪਰ ਹੀ ਉਹ ਜਿਹੜਾ ਫੋਕਸ ਕਰਕੇ ਚੱਲ ਰਿਹਾ ਲੇਕਿਨ ਅੱਜ ਕੱਲ੍ਹ ਦਾ ਜੋ ਟਾਈਮ ਚੱਲ ਰਿਹਾ ਨਾ ਅੱਜ ਕੱਲ੍ਹ ਦੇ ਸਮੇਂ ਦੇ ਨਾਲ ਅਗਰ ਆਪਾਂ ਬੱਚੇ ਨੂੰ ਚਲਾਉਣਾ ਆ ਤਾਂ ਆਪਾਂ ਨੂੰ ਬੱਚੇ ਨੂੰ ਐਕਟੀਵਿਟੀਜ਼ ਦੇ ਵਿੱਚ ਪਾਉਣਾ ਵੀ ਬਹੁਤ ਜ਼ਰੂਰੀ ਹੈ ਜੋ ਮੇਰੇ ਨਜ਼ਰੀਏ ਤੋਂ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਵਿਜਿਟ ਕੀਤਾ ਡਿਸਪ ਦੇ ਵਿੱਚ ਅਤੇ ਰਮਨ ਮੈਂ ਸੋਚ ਰਹੀ ਹਾਂ ਕਿ ਮੈਂ ਵੀ ਕੱਲ੍ਹ ਤਾਂ ਚਲੋ ਸੰਡੇ ਆ ਨਾ ਫਿਰ ਮੰਡੇ ਨੂੰ ਮੈਂ ਵੀ ਇੱਕ ਵਾਰੀ ਜਾ ਕੇ ਆਵਾਂ ਉੱਥੇ ਅਤੇ ਆਪਣੀ ਬੇਟੀ ਨੂੰ ਵੀ ਦਿਖਾ ਕੇ ਲਿਆਵਾਂ ਜੀ ਜੀ ਜੀ ਬਿਲਕੁਲ ਦੇਖੋ ਇੱਕ ਮਾਤਾ ਪਿਤਾ ਹੋਣ ਦੇ ਨਾਤੇ ਤਾਂ ਅਸੀਂ ਇਹ ਹਮੇਸ਼ਾ ਚਾਹੁੰਦੇ ਹਾਂ ਕਿ ਸਾਡਾ ਬੱਚਾ ਇੱਕ ਵਧੀਆ ਸਕੂਲ 'ਚ ਪੜ੍ਹੇ ਅਤੇ ਇੱਕ ਇੱਦਾਂ ਦੀ ਜਗ੍ਹਾ 'ਤੇ ਜਾਏ ਜਿੱਥੇ ਬੱਚਾ ਸੁਰੱਖਿਅਤ ਵੀ ਹੋਵੇ ਵੇਖੋ ਸੇਫ ਵੀ ਹੋਵੇ ਹੈ ਨਾ ਅਤੇ ਫਿਰ ਮੈਂ ਸੋਚਦੀ ਹਾਂ ਚਲੋ ਮੈਂ ਨਾ ਘਰੇ ਇੱਕ ਵਾਰੀ ਡਿਸਕਸ ਕਰੂੰਗੀ ਅਤੇ ਜ਼ਰੂਰ ਅਸੀਂ ਮੰਡੇ ਤੁਹਾਡੇ ਕਹੇ 'ਤੇ ਜਾ ਕੇ ਆਵਾਂਗੇ ਜੇ ਗੱਲ ਬਣੀ ਤਾਂ ਮੈਂ ਪੱਕਾ ਤੁਹਾਨੂੰ ਕਾਲ ਕਰਕੇ ਜ਼ਰੂਰ ਦੱਸੂਗੀ ਜ਼ਰੂਰ ਜ਼ਰੂਰ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਦੱਸੂਗੀ ਜਿੱਦਾਂ ਬਣਦਾ ਠੀਕ ਹੈ ਓਕੇ ਜੀ ਚੰਗਾ